ਹਾਂਜੀ ਖਾਣਾ ਬਣਾਉਣ ਸਮੇਂ ਸਾਨੂੰ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਸਭ ਤੋਂ ਪਹਿਲਾਂ ਰਸੋਈ ਵਿੱਚ ਕੰਮ ਕਰਨ ਤੋਂ ਪਹਿਲਾਂ ਸਾਨੂੰ ਆਪਣੀ ਰਸੋਈ ਚੁੱਲ੍ਹਾ ਬਰਤਨ ਅਤੇ ਆਪਣੇ ਹੱਥ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ ਫੇਰ ਜਿਹੜੀ ਵੀ ਸਬਜ਼ੀ ਦਾਲ ਅਸੀਂ ਬਣਾਉਣੀ ਹੈ ਉਸ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਧੋਣਾ ਚਾਹੀਦਾ ਹੈ ਤਾਂ ਜੋ ਉਸ ਵਿਚਲਾ ਮਿੱਟੀ ਘੱਟਾ ਜਾਂ ਕੀਟਾਣੂਆਂ ਤੋਂ ਰਹਿਤ ਹੋ ਸਕੇ ਫਿਰ ਸਬਜ਼ੀ ਨੂੰ ਸਹੀ ਤਰੀਕੇ ਨਾਲ ਕੱਟਣਾ ਵੱਢਣਾ ਵੀ ਜ਼ਰੂਰੀ ਹੁੰਦਾ ਹੈ ਤਾਂ ਜੋ ਉਹਨਾਂ ਵਿੱਚ ਕੋਈ ਕੀੜਾ ਮਕੌੜਾ ਨਾ ਹੋਵੇ ਫਿਰ ਘਿਓ ਤੇਲ ਅਤੇ ਮਸਾਲਿਆਂ ਦੀ ਵਰਤੋਂ ਵੀ ਸਾਨੂੰ ਬੜੇ ਧਿਆਨ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਘਰ ਵਿੱਚ ਜੇ ਕੋਈ ਬਜ਼ੁਰਗ ਜਾਂ ਮਰੀਜ਼ ਹੈ ਤਾਂ ਉਹਨਾਂ ਨੇ ਵੀ ਉਹੀ ਭੋਜਨ ਖਾਣਾ ਹੁੰਦਾ ਹੈ ਫਿਰ ਖਾਣਾ ਬਣਾਉਂਦੇ ਸਮੇਂ ਗੈਸ ਦੀ ਆਂਚ ਵੀ ਧਿਆਨ ਨਾਲ ਸੈਟ ਕਰਨੀ ਚਾਹੀਦੀ ਹੈ ਤਾਂ ਜੋ ਖਾਣਾ ਸਹੀ ਤਰੀਕੇ ਨਾਲ ਪੱਕ ਜਾਵੇ ਗੈਸ ਦੀ ਆਂਚ ਇੰਨੀ ਤੇਜ਼ ਨਹੀਂ ਹੋਣੀ ਚਾਹੀਦੀ ਕਿ ਖਾਣਾ ਜਲਦੀ ਹੀ ਜਲ ਜਾਵੇ ਸਗੋਂ ਆਂਚ ਧੀਮੀ ਹੋਣੀ ਚਾਹੀਦੀ ਹੈ ਤਾਂ ਜੋ ਖਾਣਾ ਸਹਿਜੇ ਸਹਿਜੇ ਚੰਗੀ ਤਰ੍ਹਾਂ ਪੱਕ ਜਾਵੇ ਇਸ ਤੋਂ ਇਲਾਵਾ ਖਾਣਾ ਬਣਾਉਣ ਸਮੇਂ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਸਰੀਰ ਨੂੰ ਸੇਕ ਨਾ ਲੱਗ ਸਕੇ